ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਤਕਨੋਲਜੀ ਦਾ ਸਾਡੇ ਜੀਵਨ ਦੇ ਵਿੱਚ ਕੀ ਮਹੱਤਵ ਹੈ ਤਕਨੋਲਜੀ ਆਪਣੇ ਆਪ ਦੇ ਨਾਲ ਅ ਸਾਡੀ ਕੁਦਰਤ ਦੇ ਨਾਲ ਮਿਲ ਕੇ ਇਨਸਾਨ ਨੂੰ ਕਿੰਨੇ ਹੀ ਅਲੱਗ ਅਲੱਗ ਤਰੀਕੇ ਦੀਆਂ ਕਾਢਾਂ ਦਿੱਤੀਆਂ ਹਨ ਜਿਸ ਨੇ ਮਨੁੱਖੀ ਜੀਵਨ ਨੂੰ ਅੱਗੇ ਤੋਂ ਅੱਗੇ ਲੈ ਕੇ ਜਾਣ ਦਾ ਮੰਤਵ ਬਣਾਇਆ ਹੈ ਤਕਨੋਲਜੀ ਦਾ ਅੱਜ ਦੇ ਸਮੇਂ ਵਿੱਚ ਸਾਡੇ ਲਈ ਬਹੁਤ ਹੀ ਜ਼ਿਆਦਾ ਉਪ ਉਪ ਉਪਯੋਗ ਕੀਤਾ ਜਾਂਦਾ ਹੈ ਜੋ ਕਿ ਸਾਡੇ ਜੀਵਨ ਨੂੰ ਲਾਭਦਾਇਕ ਬਣਾਉਂਦਾ ਹੈ ਅਤੇ ਅਗਰ ਮੈਨੂੰ ਭਵਿੱਖ ਦੀ ਯਾਤਰਾ ਕਰ ਕਰਨ ਕਾਰਨ ਕਿਤੇ ਤੈਕਨੋਲਜੀ ਨੂੰ ਵਿਕਸਿਤ ਹੋਏ ਦੇਖਣ ਨੂੰ ਜਾਣਾ ਚਾਹੀਦਾ ਹੈ ਤਾਂ ਮੈਂ ਸਭ ਤੋਂ ਪਹਿਲਾਂ ਜਪਾਨ ਦੇਸ਼ ਨੂੰ ਜਾਣਾ ਚਾਹਾਂਗਾ ਜਿੱਥੇ ਦੀ ਤਕਨੋਲਜੀ ਆਮ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਵੱਡੀ ਮੰਨੀ ਜਾਣ ਵਾਲੀ ਤੈਕਨੋਲੋਜੀ ਹੈ ਜਿਸ ਨੇ ਆਪਣੇ ਦੇਸ਼ ਦੇ ਨਾਲ ਨਾਲ ਸਾਰੇ ਪੂਰੇ ਭਵਿਖ ਦੇਸ਼ ਨੂੰ ਸਾਰਿਆਂ ਨੂੰ ਅੱਗੇ ਵਧਾਇਆ ਹੈ ਉਹਨਾਂ ਦੀ ਤਕਨੋਲਜੀ ਆਮ ਦੇਸ਼ਾਂ ਨਾਲੋਂ ਪੰਦਰਾਂ ਵੀਹ ਸਾਲ ਅੱਗੇ ਦੀ ਸੋਚ ਮੰਨ ਕੇ ਤਕਨੋਲਜੀ ਬਣੀ ਹੋਈ ਹੈ ਅਤੇ ਉਹਨਾਂ ਨੇ ਬਹੁਤ ਹੀ ਜ਼ਿਆਦਾ ਸਾਇੰਸ ਦੇ ਨਾਲ ਮਿਲ ਕੇ ਅਲੱਗ ਅਲੱਗ ਕਾਢਾਂ ਕੀਤੀਆਂ ਹਨ ਜੋ ਕਿ ਇਨਸਾਨੀ ਸਰੀਰ ਤੋਂ ਲੈ ਕੇ ਇਨਸਾਨੀ ਸੋਚ ਤੱਕ ਅਲੱਗ ਅਲੱਗ ਤਰੀਕੇ ਦੀ ਤਕਨੋਲਜੀ ਨੂੰ ਦਿਖਾਉਂਦੀਆਂ ਹਨ ਅਤੇ ਮਦਦ ਕਰਦੀਆਂ ਹਨ ਜਿਸ ਦੇ ਨਾਲ ਸਾਨੂੰ ਹੋਰ ਵੀ ਅੱਗੇ ਤੱਕ ਦਾ ਵਾਧ ਮਿਲੇਗੀ